ਸਾਡੇ ਅੰਮ੍ਰਿਤਸਰ ਵਿੱਚ ਕਾਫੀ ਪੁਰਾਣੇ ਸਮੇਂ ਤੌਰ ਤੋਂ ਲੋਕ ਨਸਲੀ ਲੋਕ 'ਤੇ ਸਮੂਹ ਭਾਸ਼ਾਵਾਂ ਆਦਿ ਹਨ ਇੱਥੇ ਕਾਫੀ ਸਮੇਂ ਤੋਂ ਲੋਕ ਇਕੱਠੇ ਮਿਲ ਕੇ ਰਹਿੰਦੇ ਹਨ ਅਤੇ ਆਪਣੇ ਇੱਥੇ ਗੱਲਬਾਤ ਕਰਦੇ ਸਨ ਸਾਡੀ ਪਾ ਪੰਜਾਬੀ ਭਾਸ਼ਾ ਹੈ ਅਤੇ ਆਪਾਂ ਆਪਸ ਵਿੱਚ ਮਿਲ ਜੁਲ ਸਾਡਾ ਸਾਰਾ ਪਰਿਵਾਰ ਮਿਲ ਜੁਲ ਕੇ ਰਹਿੰਦਾ ਹੈ ਮੇਰੇ ਸਾਡੇ ਘਰ ਵਿੱਚ ਜਿਵੇਂ ਕਿ ਮੇਰੇ ਚਾਚਾ ਜੀ ਹਨ ਅਤੇ ਮੇਰੇ ਚਾਚੀ ਜੀ ਵਗੈਰਾ ਹਨ ਅਤੇ ਆਪਾਂ ਸਾਰੇ ਇਕੱਠੇ ਮਿਲ ਕੇ ਹੀ ਰਹਿੰਦੇ ਹਨ ਮੇਰੇ ਪਾਪਾ ਦੇ ਦੋ ਭਰਾ ਸਨ ਇਹ ਦੋ ਚਾਚੇ ਸਨ ਮੇਰੇ ਇੱਕ ਚਾਚਾ ਸਾਡੇ ਘਰ ਵਿੱਚ ਹੀ ਰਹਿੰਦਾ ਹੈ ਅਤੇ ਇੱਕ ਚਾਚੇ ਨੇ ਆਪਣਾ ਘਰ ਬਣਾਇਆ ਹੋਇਆ ਹੈ ਲੇਕਿਨ ਉਹ ਵੀ ਸਾਨੂੰ ਮਿਲਣ ਜੁਲਣ ਆਉਂਦੇ ਹਨ ਅਤੇ ਆਪਾਂ ਸਾਰੇ ਇਕੱਠੇ ਮਿਲ ਕੇ ਰਹਿੰਦੇ ਹਾਂ ਅਤੇ ਆਪਾਂ ਆਪਣੇ ਪੰਜਾਬੀ ਭਾਸ਼ਾ ਦੀ ਹੀ ਵਰਤੋਂ ਕਰਦੇ ਹਨ ਸਾਡੇ ਸੱਭਿਆਚਾਰ ਵਿੱਚ ਕਬੀਲੇ ਵਿੱਚ ਕਬੀਲੇ ਵਿੱਚ ਪੰਜਾਬੀ ਭਾਸ਼ਾ ਹੀ ਬੋਲਦੇ ਹਨ ਲੇਕਿਨ ਸਾਡੇ ਕਈ ਥਾਵਾਂ ਜਿਵੇਂ ਸਾਡੇ ਘਰ ਤੋਂ ਬਾਹਰ ਸਾਡੇ ਸਾਹਮਣੇ ਮੁਸਲਮਾਨ ਲੋਕ ਰਹਿੰਦੇ ਸਨ ਉਹ ਆਪਣੀ ਮੁਸਲਮਾਨੀ ਭਾਸ਼ਾ ਆਪਣੇ ਘਰ ਵਿੱਚ ਹੀ ਲੇਕਿਨ ਬੋਲਦੇ ਸਨ ਲੇਕਿਨ ਜਦੋਂ ਵੀ ਉਹ ਸਾਡੇ ਨਾਲ ਗੱਲਬਾਤ ਕਰਦੇ ਸਨ ਅਤੇ ਉਹ ਆਪਣੀ ਪੰਜਾਬੀ ਭਾਸ਼ਾ ਹੀ ਸਾਡੇ ਨਾਲ ਬੋਲਦੇ ਸਨ ਲੇਕਿਨ ਜਦੋਂ ਉਹ ਆਪਸ ਵਿੱਚ ਆਪਣੇ ਘਰ ਵਿੱਚ ਗੱਲਬਾਤ ਕਰਦੇ ਸਨ ਅਤੇ ਉਹ ਆਪਣੀ ਮੁਸਲਮਾਨ ਭਾਸ਼ਾ ਬੋਲਦੇ ਸਨ ਲੇਕਿਨ ਉਹ ਵੀ ਆਪਣੇ ਗ੍ਰੰਥ ਦਾ ਪਾਲਨ ਕਰਦੇ ਸਨ ਜਿਵੇਂ ਆਪਾਂ ਵੀ ਆਪਣੇ ਗ੍ਰੰਥ ਦਾ ਪਾਲਣ ਕਰਦੇ ਸਨ ਅਤੇ ਆਪਾਂ ਸਾਡੇ ਹੋਰ ਵੀ ਆਪਾਂ ਜਿਵੇਂ ਹੋਰ ਵੀ ਜਿਵੇਂ ਕਸਬਿਆਂ ਵਿੱਚ ਜਾਂਦੇ ਹਨ ਜਿਵੇਂ ਕਿ ਆਪਾਂ ਗਾਓਂ ਵਿੱਚ ਜਾਂਦੇ ਹਨ ਉੱਥੇ ਲੋਕ ਆਪਣੀ ਆਪਣੀ ਭਾਸ਼ਾ ਬੋਲਦੇ ਸਨ ਵੱਖ ਜ਼ਿਲ੍ਹੇ ਹੋਰ ਵੀ ਕਈ ਪੱਧਰ ਥਾਵਾਂ 'ਤੇ ਆਪਾਂ ਜਾਂਦੇ ਸਨ ਜਿੱਥੇ ਆਪਣੀਆਂ ਆਪਣੀਆਂ ਲੋਕ ਭਾਸ਼ਾਵਾਂ ਬੋਲਦੇ ਸਨ ਸਾਡੇ ਲਾਗੇ ਜਿਵੇਂ ਕਿ ਹੋਰ ਵੀ ਲੋਕ ਜਿਵੇਂ ਦੁਆਬੀ ਪੁਆਬੀ ਮਾਲਵੇ ਦੀ ਭਾਸ਼ਾ ਵੀ ਬੋਲਦੇ ਸਨ ਸਾਡੇ ਇੱਥੇ ਕਈ ਸਿੱਖ ਲੋਕ ਵੀ ਸਨ ਅਤੇ ਕਈ ਹਿੰਦੂ ਵੀ ਹਨ ਅਤੇ ਕਈ ਮੁਸਲਮਾਨ ਲੋਕ ਸਨ ਅਤੇ ਕਈ ਕ੍ਰਿਸ਼ਨ ਵੀ ਸਨ ਜੋ ਕਿ ਆਪਣੇ ਗੁਰੂਆਂ ਦਾ ਉਪ ਆਦਰ ਕਰਦੇ ਸਨ ਲੇਕਿਨ ਆਪਾਂ ਵੀ ਆਪਣੇ ਗੁਰੂ ਦਾ ਆਦਰ ਕਰਦੇ ਹਾਂ ਅਤੇ ਆਪਣੇ ਵੀ ਵੱਖ ਵੱਖ ਭਾਸ਼ਾ ਦਾ ਆਦਰ ਕਰਦੇ ਹਨ ਲੇਕਿਨ ਜੋ ਵੀ ਸਾਡੀ ਪੰਜਾਬੀ ਭਾਸ਼ਾ ਹੈ ਆਪਣੀ ਉਹੀ ਭਾਸ਼ਾ ਦਾ ਆਪਾਂ ਆਦਰ ਕਰਦੇ ਹਾਂ